ਸੱਭਿਆਚਾਰ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੇ ਸੱਭਿਆਚਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਸ਼ਵਾਸ ਪਾਏ ਜਾਂਦੇ ਹਨ ਹਰੇਕ ਧਰਮ ਦਾ ਆਪਣਾ ਇੱਕ ਅਲੱਗ ਵਿਸ਼ਵਾਸ ਦਾ ਸਰੂਪ ਹੁੰਦਾ ਹੈ ਸਾਡੇ ਸੱਭਿਆਚਾਰ ਵਿੱਚ ਵੀ ਰੰਗੋਲੀ ਸੂਰਜ ਨੂੰ ਪਾਣੀ ਚੜ੍ਹਾਉਣਾ ਮੱਥੇ 'ਤੇ ਸੰਧੂਰ ਪਵਿੱਤਰ ਧਾਗਾ ਪਾਉਣਾ ਪੂਜਾ ਲਈ ਮੰਦਰ ਜਾਣਾ ਦਰਗਾਹ 'ਤੇ ਜਾਣਾ ਵਰਤ ਜਾਂ ਰੋਜੇ ਰੱਖਣੇ ਇਹੋ ਜਿਹੀਆਂ ਬਹੁਤ ਸਾਰੀਆਂ ਧਾਰਮਿਕ ਰੀਤਾਂ ਹਨ ਕਈ ਵਾਰੀ ਇਹ ਰੀਤਾਂ ਵਿਸ਼ਵਾਸ ਦੀ ਬਜਾਏ ਅੰਧ ਵਿਸ਼ਵਾਸ ਦਾ ਰੂਪ ਵੀ ਲੈ ਲੈਂਦੀਆਂ ਹਨ ਜਿਸ ਵਿੱਚ ਬੰਦੇ ਨੂੰ ਬੰਦਾ ਸਮਝਣ ਤੋਂ ਇਨਕਾਰ ਕੀਤਾ ਜਾਂਦਾ ਹੈ ਜੇਕਰ ਇਹ ਅੰਧ ਵਿਸ਼ਵਾਸ ਦਾ ਰੂਪ ਨਾ ਲਵੇ ਤਾਂ ਇਹ ਵਿਸ਼ਵਾਸ ਸਾਡੇ ਸੱਭਿਆਚਾਰ ਦਾ ਇੱਕ ਸਥਾਈ ਅਤੇ ਪੱਕਾ ਹਿੱਸਾ ਬਣ ਜਾਂਦੇ ਹਨ ਜਿਸ ਵਿੱਚ ਕਿਸੇ ਦੀ ਰੀਤ ਦੇ ਨਾਲ ਜਾਂ ਕਿਸੇ ਦੇ ਕੋਈ ਕੰਮ ਕਰਨ ਦੇ ਨਾਲ ਦੂਜੇ ਨੂੰ ਜਦੋਂ ਕੋਈ ਦਿੱਕਤ ਨਹੀਂ ਹੁੰਦੀ ਤਾਂ ਉਸ ਦਾ ਸੱਭਿਆਚਾਰ ਦੇ ਵਿੱਚ ਇੱਕ ਵੱਡਾ ਰੋਲ ਬਣ ਜਾਂਦਾ ਹੈ ਜੋ ਕਿ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਜੁੜਿਆ ਹੁੰਦਾ ਹੈ